ਸਾਨੂੰ ਪਸ਼ੂਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ ਪਸ਼ੂਆਂ ਨੂੰ ਬਹੁਤ ਹੀ ਜਲਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ ਇਸ ਕਰਕੇ ਸਾਨੂੰ ਪਸ਼ੂਆਂ ਦੀ ਵਧੀਆ ਤਰੀਕੇ ਨਾਲ ਸਾਫ਼ ਸਫਾਈ ਆਲੇ ਦੁਆਲੇ ਦੀ ਸਾਫ਼ ਸਫਾਈ ਰੱਖਣੀ ਚਾਹੀਦੀ ਹੈ ਪਸ਼ੂਆਂ ਨੂੰ ਗੰਦਗੀ ਨਾਲ ਚਿੱਚੜਾਂ ਆਦਿ ਵੀ ਪੈ ਸਕਦੀਆਂ ਹਨ ਜੋ ਕਿ ਉਹਨਾਂ ਦੀ ਸਿਹਤ ਲਈ ਬਹੁਤ ਹੀ ਬੁਰਾ ਪ੍ਰਭਾਵ ਪਾਉਂਦੀਆਂ ਹਨ ਅਗਰ ਪਸ਼ੂਆਂ ਦੇ ਸਰੀਰ ਨੂੰ ਚਿੱਚੜਾਂ ਲੱਗ ਜਾਂਦੀਆਂ ਹਨ ਤਾਂ ਉਹ ਉਹਨਾਂ ਦਾ ਬਹੁਤ ਹੀ ਜ਼ਿਆਦਾ ਖੂਨ ਚੂਸਦੀਆਂ ਹਨ ਜਿਹਨਾਂ ਜਿਸ ਕਾਰਨ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਉਹ ਖਾਣਾ ਪੀਣਾ ਛੱਡ ਦਿੰਦਾ ਹੈ ਸਾਨੂੰ ਪਸ਼ੂਆਂ ਨੂੰ ਘੱਟ ਤੋਂ ਘੱਟ ਹਫ਼ਤੇ ਵਿੱਚ ਤਿੰਨ ਚਾਰ ਵਾਰੀ ਨਹਾਉਣਾ ਚਾਹੀਦਾ ਹੈ ਅਤੇ ਉਸ ਦੀ ਸਰੀਰ ਦੀ ਸਫਾਈ ਚੰਗੀ ਤਰ੍ਹਾਂ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਉਸ ਉਹ ਚਿੱਚੜਾਂ ਦਾ ਸ਼ਿਕਾਰ ਨਾ ਹੋਵੇ ਅਤੇ ਤੰਦਰੁਸਤ ਰਹੇ ਦੂਸਰੀ ਗੱਲ ਸਾਨੂੰ ਪਸ਼ੂਆਂ ਦੇ ਖਾਣ ਪੀਣ ਦਾ ਵੀ ਵਧੀਆ ਤਰੀਕੇ ਨਾਲ ਢੰਗ ਰੱਖਣਾ ਚਾਹੀਦਾ ਹੈ ਵਧੀਆ ਤਰੀਕੇ ਨਾਲ ਉਹਨਾਂ ਨੂੰ ਖਿਲਾਉਣਾ ਪਿਲਾਉਣਾ ਚਾਹੀਦਾ ਹੈ ਉਹਨਾਂ ਨੂੰ ਨਾ ਹੀ ਜ਼ਿਆਦਾ ਹਰੇ ਅਤੇ ਨਾ ਹੀ ਜ਼ਿਆਦਾ ਸੁੱਕੇ ਪੱਠੇ ਪਾਉਣੇ ਚਾਹੀਦੇ ਹਨ ਇੱਕਦਮ ਬਰਾਬਰ ਇਹ ਹਿਸਾਬ ਨਾਲ ਉਹਨਾਂ ਨੂੰ ਪੱਠੇ ਪਾਉਣੇ ਚਾਹੀਦੇ ਇਸ ਨਾਲ ਉਹਨਾਂ ਦਾ ਪੇਟ ਦੀ ਖ਼ਰਾਬ ਹੋ ਸਕਦਾ ਹੈ ਅਤੇ ਸਾਨੂੰ ਉਹਨਾਂ ਨੂੰ ਪਾਣੀ ਵੀ ਟ ਸਮੇਂ ਸਿਰ ਦੱਸਣਾ ਚਾਹੀਦਾ ਹੈ ਜੇ ਅਸੀਂ ਉਹਨਾਂ ਨੂੰ ਖਾਲੀ ਪੇਟ ਪਾਣੀ ਦੱਸਾਂਗੇ ਤਾਂ ਉਹਨਾਂ ਦਾ ਪੇਟ ਖ਼ਰਾਬ ਹੋ ਜਾਵੇਗਾ ਜਿਸ ਕਾਰਨ ਪਸ਼ੂ ਬਿਮਾਰ ਹੋ ਜਾਵੇਗਾ ਅਤੇ ਖਾਣਾ ਪੀਣਾ ਛੱਡ ਦੇਵੇਗਾ ਪਸ਼ੂ ਨੂੰ ਵਰਖਾ ਵਿੱਚ ਵੀ ਨਹੀਂ ਰੱਖਣਾ ਚਾਹੀਦਾ ਜ ਜ਼ਿਆਦਾਤਰ ਉਸ ਸਮੇਂ ਜਦੋਂ ਪਸ਼ੂ ਨੂੰ ਪਹਿਲਾਂ ਧੁੱਪ ਲੱਗੀ ਹੋਵੇ ਅਤੇ ਬਾਅਦ ਉਸ 'ਤੇ ਵਰਖਾ ਪੈ ਜਾਵੇ ਤਾਂ ਪਸ਼ੂ ਨੂੰ ਬੁਖਾਰ ਹੋ ਜਂਦਾ ਹੈ ਉਸਦੇ ਕਾਰਨ ਵੀ ਉਹ ਖਾਣਾ ਪੀਣਾ ਛੱਡ ਸਕ ਖਾ ਛੱਡ ਜਾਂਦਾ ਹੈ ਤਾਂ ਬਿਮਾ ਛੱਡ ਜਾਂਦਾ ਹੈ ਤਾਂ ਕਮਜ਼ੋਰ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਪਸ਼ੂਆਂ ਨੂੰ ਵਧੀਆ ਤਰੀਕੇ ਨਾਲ ਚੰਗੀ ਤਰ੍ਹਾਂ ਨਾਲ ਉਹਨਾਂ ਦਾ ਧਿਆਨ ਦੇਖ ਭਾਲ ਕਰਨੀ ਚਾਹੀਦੀ ਹੈ ਅਤੇ ਸਾਨੂੰ ਪਸ਼ੂਆਂ ਨੂੰ ਜ਼ਿਆਦਾ ਦੇਰ ਤੱਕ ਧੁੱਪ ਰੱਖ ਕੇ ਉਸ ਤੋਂ ਬਾਅਦ ਪਾਣੀ ਨਹੀਂ ਦੱਸਣਾ ਚਾਹੀਦਾ ਇਸ ਕਾਰਨ ਉਹਨਾਂ ਦੀ ਉਹਨਾਂ ਨੂੰ ਹਾਰਟ ਅਟੈਕ ਆਦਿ ਅਟੈਕ ਆ ਸਕਦੇ ਹਾਂ ਜਿਹਨਾਂ ਨਾਲ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ